ਸੇਓ ਭਾਅ ਜੀ ਬਣਾਉਣ ਦੀ ਵਿਧੀ ਬਾਈ ਜਦ ਪਹਿਲਾਂ ਆਪਾਂ ਨੇ ਤੜਕਾ ਲਾ ਕੇ ਵਿੱਚ ਦੁੱਧ ਪਾ ਕੇ ਉਹ ਤੋਂ ਬਾਅਦ ਜਿਹੜੀ ਸੇ ਸੇਵ ਕਹਿ ਦਿੰਦੇ ਹਾਂ ਪਕੌੜੀਆਂ ਨੂੰ ਪਕੌੜੀਆਂ ਪਾ ਕੇ ਬਾ ਉਹਨੂੰ ਉਹਦੇ ਬਾਅਦ ਰਿੱਝਣ ਲਈ ਛੱਡ ਦੇਣਾ ਹੁਣ ਹਲਕੇ ਹਲਕੇ ਸੇਕ 'ਤੇ ਬਾ ਜਦੋਂ ਉਹ ਐਨ ਗਾੜ੍ਹੀ ਹੋ ਗਈ ਮਤਲਬ ਉਹ ਤੋਂ ਉਹ ਸਮਝ ਲਉ ਸੇਓ ਭਾਅ ਜੀ ਤੁਹਾਡੀ ਤਿਆਰ ਹੈ ਔਰ ਉਸ ਤੋਂ ਬਾਅਦ ਖਾਣੇ ਦਾ ਆਨੰਦ ਤੁਸੀਂ ਆਪ ਮਾਣ ਸਕਦੇ ਹੋ